ਪੇਂਡੂ ਖੇਤਰ ਵਿੱਚ ਆਉਣ ਵਾਲੀਆਂ ਖੇਡਾਂ ਦੇ ਨਾਮ ਬਾਂਦਰ ਕਿੱਲਾ ਪਿੱਠੂ ਗਰਮ ਜੰਜੀਰ ਸ਼ੂ ਬਰਫ ਪਾਣੀ ਲੁੱਕਣ ਮੀਚੀ ਖੋ ਖੋ ਊਚ ਨੀਚ ਅਤੇ ਇਸ ਦੇ ਉਲਟ ਸ਼ਹਿਰੀ ਖੇਤਰ ਵਿੱਚ ਹੋਣ ਵਾਲੀਆਂ ਖੇਡਾਂ ਬਾਸਕਟਬਾਲ ਕ੍ਰਿਕਟ ਫੁੱਟਬੋਲ ਟੈਨਿਸ ਆਦਿ ਹਨ ਹੇਠਲੇ ਪੇਂਡੂ ਖੇਤਰ ਵਿੱਚ ਆਉਣ ਵਾਲੀਆਂ ਖੇਡਾਂ ਹੇਠਲੇ ਪੱਧਰ 'ਤੇ ਕੀਤੀਆਂ ਜਾਂਦੀਆਂ ਹਨ ਅਤੇ ਜ਼ਿਆਦਾਤਰ ਆਊਟਡੋਰ ਹੁੰਦੀਆਂ ਹਨ ਪੇਂਡੂ ਜੀਵਨ ਵਿੱਚ ਕੁਸ਼ਤੀਆਂ ਦੰਗਲ ਖੇਡਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਸ਼ਹਿਰੀ ਖੇਤਰ ਵਿੱਚ ਇਹ ਵਧੀਆ ਤਰੀਕੇ ਨਾਲ ਕਰਾਈਆਂ ਜਾਂਦੀਆਂ ਹਨ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਟੂਰਨਾਮੈਂਟ ਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਨਿਸ਼ ਨਿਸ਼ਚਿਤ ਕੀਤੇ ਨਾਮ ਖਿਡਾਰੀ ਖੇਡਦੇ ਹਨ ਇਹ ਕਈ ਕਿਸਮਾਂ ਦੀਆਂ ਹੁੰਦੀਆਂ ਹਨ ਜਿਵੇਂ ਕਿ ਕ੍ਰਿਕਟ ਫੁੱਟਬੋਲ ਬਾਸਕਟਬਾਲ ਵਾਲੀਬਾਲ ਆਦਿ ਪੇਂਡੂ ਜੀਵਨ ਦੀਆਂ ਖੇਡਾਂ ਸ਼ਹਿਰੀ ਜੀਵਨ ਨਾਲੋਂ ਬਹੁਤ ਪੁਰਾਣੇ ਸਮੇਂ ਦੀਆਂ ਹੁੰਦੀਆਂ ਹਨ ਪੇਂਡੂ ਜੀਵਨ ਵਿੱਚ ਪਿੰਡਾਂ ਵਿੱਚ ਢਾਲ ਇਕੱਠੀ ਕਰਕੇ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਸ਼ਹਿਰ ਵਿੱਚ ਇੱਕ ਖਾਸ ਵਿਅਕਤੀ ਖੇਡਾਂ ਕਰਵਾਉਂਦਾ ਹੈ